ਰੂਪਨਗਰ ਜ਼ਿਲ੍ਹੇ 'ਤੇ ਮਹੱਤਵਪੂਰਨ ਪ੍ਰਭਾਵ ਪਾਉਣ ਵਾਲੀਆਂ ਸਰਕਾਰੀ ਨੀਤੀਆਂ ਜਿਵੇਂ ਕਿ ਸੈਂਟਰ ਸਰਕਾਰ ਦੀ ਔਰ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਾਲੀ 'ਤੇ ਅੱਗ ਲਗਾਉਣ ਨੂੰ ਖਤਮ ਕੀਤਾ ਜਾਵੇ ਇਸ ਵਿੱਚ ਪਰ ਏਕੜ ਦੋ ਹਜ਼ਾਰ ਰੁਪਇਆ ਦਿੱਤਾ ਜਾਂਦਾ ਹੈ ਅਤੇ ਪੁਰਾਣੇ ਕਰਜ਼ ਨੂੰ ਵੀ ਮਾਫੀ ਦਿੱਤੀ ਜਾਂਦੀ ਹੈ ਦਾਲ ਆਟਾ ਸਕੀਮ ਇਹ ਸਕੀਮ ਪਰ ਮੈਂਬਰ ਪੰਦਰਾਂ ਕਿਲੋ ਕਣਕ ਦਿੱਤੀ ਜਾਂਦੀ ਹੈ ਅਤੇ ਇੱਕ ਕਿਲੋ ਦਾਲ ਦਿੱਤੀ ਜਾਂਦੀ ਹੈ ਇਹ ਸਕੀਮ ਛੇ ਮਹੀਨੇ ਵਿੱਚ ਦੋ ਵਾਰ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਕੇਂਦਰ ਸਰਕਾਰ ਦੀ ਦਾਲ ਆਟਾ ਸਕੀਮ ਉਹ ਵੀ ਲਾਗੂ ਹੁੰਦੀ ਹੈ